ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਛਾ ਬੱਚੇ ਜੇ ਤੁਸੀਂ ਬੀ ਸੀ ਏ ਕੰਮਲੀਟ ਕਰ ਲਈ ਤਾਂ ਤੁਹਾਨੂੰ ਕੋਡਿੰਗ ਵੀ ਆਉਂਦੀ ਹੈ ਤਾਂ ਤੁਸੀਂ ਮਤਲਬ ਵੈਬਸਾਈਟ ਬਣਾਉਂਣ ਦੇ ਵਿੱਚ ਮਤਲਬ ਉੱਧਰ ਨੂੰ ਜਾਓ ਆਪਣੇ ਇੱਕ ਇੱਥੇ ਚੰਡੀਗੜ੍ਹ ਵਿੱਚ ਆਈਟੀ ਕੰਪਨੀ ਹੈ ਉਹਨਾਂ ਦਾ ਪੈਕੇਜ ਵੀ ਵਧੀਆ ਹੁੰਦਾ ਮਤਲਬ ਵਧੀਆ ਤੁਹਾਨੂੰ ਹੋ ਸਕਦੀ ਤਨਖਾਹ ਮਤਲਬ ਵਧੀਆ ਮਿਲ ਜਾਵੇਗੀ ਅਤੇ ਤੁਸੀਂ ਉੱਥੇ ਜਾ ਕੇ ਉਹਨਾਂ ਨਾਲ ਗੱਲਬਾਤ ਕਰੋ ਅਤੇ ਇੱਕ ਮੇਰੀ ਗੱਲ ਸੁਣੋ ਆਪਣੀ ਡਿਗਰੀ ਅਤੇ ਸਾਰਾ ਕੁਛ ਲੈ ਕੇ ਜਾਇਓ ਠੀਕ ਹੈ ਠੀਕ